ਜਿਵੇਂ ਕਿ ਸਾਨੂੰ ਰੋਜ਼ ਹੀ ਦੇਖਣ ਨੂੰ ਮਿਲਦਾ ਹੈ ਕਿ ਲੋਕੀਂ ਜੋ ਨੇ ਉਹ ਰੋਡ ਐਕਸੀਡੈਂਟ ਦੇ ਵਿੱਚ ਘੱਟ ਜਾਂ ਫਿਰ ਜ਼ਿਆਦਾ ਜ਼ਖਮੀ ਹੋ ਜਾਂਦੇ ਨੇ ਤਾਂ ਉਸ ਵਿੱਚ ਜੋ ਹੈ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਜੇਕਰ ਗਲਤੀ ਜੋ ਹੈ ਉਹ ਇੱਕ ਪਾਰਟੀ ਦੀ ਹੈ ਇਸ ਵਿੱਚ ਅਸੀਂ ਸੋਚ ਸਕਦੇ ਹਾਂ ਜੇਕਰ ਦੋ ਗੱਡੀਆਂ ਦੀ ਟੱਕਰ ਹੋਈ ਹੈ ਅਤੇ ਇੱਕ ਗੱਡੀ ਰੋਂਗ ਸਾਈਡ ਤੋਂ ਆ ਰਹੀ ਹੈ ਅਤੇ ਰੋਂਗ ਸਾਈਡ ਤੋਂ ਆਉਣ ਵਾਲੀ ਗੱਡੀ ਗੱਡੀ ਚਾਲਕ ਦੀ ਗਲਤੀ ਹੈ ਅਤੇ ਅਗਰ ਰਾਈਟ ਸਾਈਡ ਤੋਂ ਆਉਣ ਵਾਲੀ ਗੱਡੀ ਦਾ ਕੋਈ ਨੁਕਸਾਨ ਹੋਇਆ ਹੈ ਤਾਂ ਇਹ ਰੋਂਗ ਸਾਈਡ ਤੋਂ ਆਉਣ ਵਾਲੇ ਬੰਦੇ ਦੀ ਡਿਊਟੀ ਹੋਣੀ ਚਾਹੀਦੀ ਹੈ ਕਿ ਉਹ ਉਸ ਨੁਕਸਾਨ ਦਾ ਭੁਗਤਾਨ ਕਰੇ ਜੇਕਰ ਕੋਈ ਵਾਹਨ ਚਾਲਕ ਕੋਲੋਂ ਕਿਸੇ ਪੈਦਲ ਚਾਲਕ ਨੂੰ ਟੱਕਰ ਮਾਰ ਦਿੱਤੀ ਗਈ ਹੈ ਤਾਂ ਵਾ ਅਤੇ ਗਲਤੀ ਜੋ ਹੈ ਵਾਹਨ ਚਾਲਕ ਦੀ ਹੈ ਤਾਂ ਫਿਰ ਉਸ ਬੰਦੇ ਨੂੰ ਜੋ ਪੈਦਲ ਜਾ ਰਿਹਾ ਹੈ ਇਨਸਾਨ ਉਸਦੇ ਇਲਾਜ ਦੇ ਪੈਸੇ ਯਾ ਫਿਰ ਹੋਰ ਮੁਆਵਜ਼ਾ ਦੇਣਾ ਚਾਹੀਦਾ ਹੈ ਇਹ ਇਸ ਚੀਜ਼ ਦੇ ਰਿਲੇਟਿਡ ਜੋ ਹੈ ਉਹ ਕਾਨੂੰਨ ਦੇ ਵਿੱਚ ਵੀ ਬਹੁਤ ਸਾਰੀਆਂ ਜੋ ਹੈ ਉਹ ਪ੍ਰੋਵੀਜ਼ਨਜ਼ ਨੇ ਜਿਦਾਂ ਮੋਟਰ ਵਹੀਕਲ ਐਕਟ ਦੇ ਅੰਡਰ ਜੋ ਹੈ ਉਹ ਕੰਪਨਸੇਸ਼ਨ ਕਲੇਮ ਕੀਤਾ ਜਾ ਸਕਦਾ ਹੈ ਅਗਰ ਗਲਤੀ ਜੋ ਹੈ ਉਹ ਕਿਸੇ ਇੱਕ ਬੰਦੇ ਦੀ ਹੋਵੇ ਇਸ ਤਰ੍ਹਾਂ ਨਾਲ ਜੋ ਹੈ ਉਹ ਸੜਕ ਹਾਦਸਿਆਂ ਵਿੱਚ ਗੰਭੀਰ ਤਰੀਕੇ ਨਾਲ ਜਾਂ ਫਿਰ ਜਖ਼ਮੀ ਹੋਣ ਵਾਲੇ ਇਨਸਾਨ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ